ਦਾਜ ਅੱਜ ਦੇ ਯੁੱਗ ਵਿੱਚ ਦੇਣਾ ਅਤੇ ਲੈਣਾ ਵੈਸੇ ਕਾਨੂੰਨੀ ਜੁਰਮ ਹੈ ਪਰ ਮਾਪੇ ਕਦੇ ਆਪਣੀ ਧੀ ਨੂੰ ਖਾਲੀ ਹੱਥ ਨਹੀਂ ਤੋਰਦੇ ਉਹਨਾਂ ਵੱਲੋਂ ਵੱਧ ਤੋਂ ਵੱਧ ਜੋ ਹੋ ਸਕਦਾ ਹੈ ਕਰਦੇ ਹਨ ਇਕ ਘਰ ਨੂੰ ਚਲਾਉਣ ਲਈ ਉਸ ਦੀਆਂ ਮੁੱਢਲੀਆਂ ਜ਼ਰੂਰਤਾਂ ਦਾ ਸਮਾਨ ਅਤੇ ਹੰਢਾਉਣ ਲਈ ਜ਼ਰੂਰੀ ਵਸਤੂਆਂ ਦਿੱਤੀਆਂ ਜਾਂਦੀਆਂ ਹਨ ਲਾੜੀ ਦੇ ਰਿਸ਼ਤੇਦਾਰ ਵੀ ਉਸ ਲਈ ਜ਼ਰੂਰਤ ਦੀਆਂ ਵੱਧ ਤੋਂ ਵੱਧ ਸਮਾਨ ਲੈ ਕੇ ਆਉਂਦੇ ਹਨ ਤਾਂ ਕਿ ਅੱਗੋਂ ਪਰਿਵਾਰ ਚਲਾਉਣ ਲਈ ਉਸਦੀ ਵਰਤੋਂ ਵਿੱਚ ਆ ਸਕੇ ਮਾਪੇ ਆਪਣੀ ਧੀ ਨੂੰ ਤੋਹਫ਼ੇ ਵਜੋਂ ਕਈ ਕੁਛ ਦਿੰਦੇ ਹਨ ਜਿਵੇਂ ਗਹਿਣੇ ਬਰਤਨ ਕੱਪੜੇ ਫਰਨੀਚਰ ਆਦਿ ਅਤੇ ਕਈ ਬਿਜਲੀ ਨਾਲ ਚੱਲਣ ਵਾਲੀਆਂ ਵਸਤੂਆਂ ਵੀ ਦਿੰਦੇ ਹਨ ਜਿਵੇਂ ਮਿਕਸੀ ਓਵਨ ਫਰਿਜ ਆਦਿ ਕਈ ਹੋਰ ਵਸਤੂਆਂ ਵੀ ਜਿਹੜੀ ਬਿਜਲੀ ਨਾਲ ਚੱਲਦੀਆਂ ਹਨ ਅਤੇ ਬਰਤਨ ਆਦਿ ਦਿੰਦੇ ਹਨ ਅਤੇ ਕਈ ਮਾਪੇ ਤਾਂ ਆਪਣੀ ਖੁਸ਼ੀ ਵਜੋਂ ਲਾੜੇ ਨੂੰ ਮੋਟਰ ਗੱਡੀਆਂ ਆਦਿ ਵੀ ਦਿੰਦੇ ਹਨ ਅਤੇ ਲਾੜੇ ਦੇ ਰਿਸ਼ਤੇਦਾਰ ਨੂੰ ਕੱਪੜੇ ਤੋਹਫ਼ੇ ਵੀ ਦਿੰਦੇ ਹਨ ਲਾੜੀ ਆਪਣੇ ਨਾਲ ਕਈ ਕੁਝ ਤੋਹਫ਼ੇ ਵਜੋਂ ਲੈ ਕੇ ਜਾਂਦੀ ਹੈ ਜਿਵੇਂ ਸੋਨੇ ਦੇ ਕੀਮਤੀ ਗਹਿਣੇ ਹੋਰ ਕੀਮਤੀ ਵਸਤਾਂ ਵੀ ਜਿਸ ਨੂੰ ਸਮਾਜ ਨੇ ਦਾਜ ਦਾ ਨਾਮ ਦਿੱਤਾ ਹੈ ਅਸਲ ਵਿੱਚ ਇਹ ਆਪਣੀ ਖੁਸ਼ੀ ਵਜੋਂ ਤੋਹਫ਼ੇ ਦਿੱਤੇ ਜਾਂਦੇ ਹਨ